ਸਾਡੇ ਖੇਤਰ ਵਿੱਚ ਕਲਾ ਅਤੇ ਵ ਸੱਭਿਆਚਾਰਕ ਦੇ ਵਿਕਾਸ ਵਿੱਚ ਸਹਾਇਤਾ ਕਰਨ ਵਾਲੇ ਫੀਡਿੰਗ ਸਰੋਤ ਜਿਵੇਂ ਕਿ ਸਰਕਾਰ ਕਾਰਪੋਰੇਟ ਪਰਉਪਕਾਰੀ ਦਾਨੀ ਏਜੰਸੀਆਂ ਹਨ ਜਿਵੇਂ ਸੱਭਿਆਚਾਰ ਮੰਤਰਾਲਾ ਕਲਾ ਅਤੇ ਸੱਭਿਆਚਾਰ ਦੇ ਸਾਰੇ ਰੂਪਾਂ ਦੇ ਸਮੁੱਚੇ ਪਸਾਰ ਵਿੱਚ ਹਿੱਸਾ ਲੈਣ ਲਈ ਆਪਣੀਆਂ ਵੱਖ ਵੱਖ ਯੋਜਨਾਵਾਂ ਰਾਹੀਂ ਗੈਰ ਸਰਕਾਰੀ ਸੰਸਥਾਵਾਂ ਜਿਵੇਂ ਐੱਨ ਜੀ ਓ ਅਤੇ ਸਵੈ ਸੇਵੀ ਸੰਸਥਾਵਾਂ ਦਾ ਸਮਰਥਨ ਕਰ ਰਿਹਾ ਹੈ ਕਲਾ ਅਤੇ ਸੰਸਕ੍ਰਿਤੀ ਦੇ ਸਾਰੇ ਰੂਪਾਂ ਨੂੰ ਮੂਰਤ ਅਤੇ ਅਮੂਰਤ ਦੋਵੇਂ ਰੂਪਾਂ ਨੂੰ ਉਤਸ਼ਾਹਿਤ ਕਰਨ ਸਮੇਤ ਇਸ ਦੇ ਆਦੇਸ਼ ਨੂੰ ਪੂਰਾ ਕਰਨ ਲਈ ਮੰਤਰਾਲੇ ਕੋਲ ਲੋੜੀਂਦੇ ਫੰਡ ਉਪਲਬਧ ਹਨ ਇਸਦੇ ਨਾਲ ਨਾਲ ਹੀ ਕਈ ਤਰ੍ਹਾਂ ਦੇ ਜਿਵੇਂ ਕਿ ਐੱਨ ਜੀ ਓਜ ਦੀ ਵੱਧ ਤੋਂ ਵੱਧ ਭਾਗੀਦਾਰੀ ਲਈ ਇਹਨਾਂ ਸਕੀਮਾਂ ਦੇ ਦਿਸ਼ਾ ਨਿਰਦੇਸ਼ ਅਤੇ ਅਰਜ਼ੀ ਫਾਰਮ ਮੰਤਰਾਲੇ ਦੀ ਅਧਿਕਾਰਤ ਵੈਬਸਾਈਟ 'ਤੇ ਅਪਲੋਡ ਕੀਤੇ ਗਏ ਹਨ ਵੱਖ ਵੱਖ ਅਖਬਾਰਾਂ ਅਧਿਕਾਰਤ ਵੈਬਸਾਈਟ ਅਤੇ ਮੰਤਰਾਲੇ ਦੇ ਸੋਸ਼ਲ ਮੀਡੀਆ ਪਲੇਟਫੋਮਾਂ ਅਤੇ ਸਕੀਮ ਦੇ ਸੰਬੰਧਿਤ ਨੋਡਲ ਏਜੰਸੀ ਰਾਹੀਂ ਇਹਨਾਂ ਸਕੀਮਾਂ ਅਧੀਨ ਅਰਜ਼ੀਆਂ ਮੰਗਣ ਵਾਲੇ ਇਸ਼ਤਿਹਾਰਾਂ ਦਾ ਵਿਆਪਕ ਪ੍ਰਾਚੀਨ ਵੀ ਕੀਤਾ ਜਾਂਦਾ ਹੈ ਗੁਰੂ ਸ਼ੀਸ਼ਯ ਪਰੰਪਰਾ ਦੇ ਪ੍ਰਚਾਰ ਲਈ ਵਿੱਤੀ ਸਹਾਇਤਾ ਇਸ ਯੋਜਨਾ ਦਾ ਉਦੇਸ਼ ਨਾਟਕੀ ਸਮੂਹਾਂ ਥੀਏਟਰ ਸਮੂਹਾਂ ਸੰਗੀਤ ਸਮੂਹਾਂ ਬਾਲ ਥੀਏਟਰ ਆਦਿ ਵਰਗੀਆਂ ਕਲਾ ਦੀਆਂ ਗਤੀਵਿਧੀਆਂ ਦੀਆਂ ਸਾਰੀਆਂ ਸਹਿਸ਼ਿਤ ਸ਼ੈਲੀਆਂ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਅਤੇ ਕਲਾਕਾਰਾਂ ਨੂੰ ਉਹਨਾਂ ਦੇ ਗੁਰੂ ਦੁਆਰਾ ਸਿਖਲਾਈ ਪ੍ਰਦਾਨ ਕਰਨਾ ਹੈ ਸਕੀਮ ਦੇ ਅਨੁਸਾਰ ਥੀਏਟਰ ਦੇ ਖੇਤਰ ਵਿੱਚ ਇੱਕ ਗੁਰੂ ਅਤੇ ਵੱਧ ਤੋਂ ਵੱਧ ਅਠਾਰਾਂ ਸ਼ਿੱਸ਼ਿਆਂ ਅਤੇ ਸੰਗਤ ਨ੍ਰਿੱਤ ਦੇ ਖੇਤਰ ਵਿੱਚ ਇੱਕ ਗੁਰੂ ਅਤੇ ਵੱਧ ਤੋਂ ਵੱਧ ਆਹ ਸ਼ਿੱਸ਼ਿਆਂ ਨੂੰ ਸਹਾਇਤਾ ਪ੍ਰਦਾਨ ਕਰਦੀ ਹੈ ਰਾਸ਼ਟਰੀ ਮੌਜੂਦਗੀ ਵਾਲੀਆਂ ਸੱਭਿਆਚਾਰਕ ਸੰਸਥਾਵਾਂ ਨੂੰ ਵਿੱਤੀ ਸਹਾਇਤਾ ਸਕੀਮ ਦੇ ਹਿੱਸੇ ਦਾ ਉਦੇਸ਼ ਰਾਸ਼ਟਰੀ ਮਜਦੂ ਮੌਜੂਦਗੀ ਵਾਲੇ ਨਾਮਵਰ ਸੱਭਿਆਚਾਰ ਸੰਸਥਾਵਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ਮੁਨਾਫਾ ਨਾ ਕਰਨ ਵਾਲੇ ਸੰਸਥਾਵਾਂ ਗੈਰ ਸਰਕਾਰੀ ਸੰਸਥਾਵਾਂ ਸੁਸਾਇਟੀਆਂ ਟਰੱਸਟ ਯੂਨੀਵਰਸਿਟੀਆਂ ਏਜੰਸੀਆਂ ਆਦਿ ਅਤੇ ਵੱਖ ਵੱਖ ਸੱਭਿਆਚਾਰਕ ਗਤੀਵਿਧੀਆਂ ਦਾ ਆਯੋਜਨ ਕਰਕੇ ਕਲਾ ਅਤੇ ਸੱਭਿਆਚਾਰਕ ਦੇ ਪ੍ਰਸਾਰ ਅਤੇ ਅਤੇ ਪਰਉਪਕਾਰੀ ਜਿਵੇਂ ਕਿ ਦਾਨੀ ਏਜੰਸੀਆਂ ਅਤੇ ਵੱਖ ਵੱਖ ਤਰ੍ਹਾਂ ਦੇ ਉਪਰਾਲੇ ਨਾਲ ਸਾਡੇ ਦੇਸ਼ ਵਿੱਚ ਖੇਤਰ ਅਤੇ ਕਲਾ ਦੇ ਸੱਭਿਆਚਾਰ ਦੇ ਵਿਕਾਸ ਦੀ ਸਹਾਇਤਾ ਅਤੇ ਕੁਝ ਇਹ ਸਰੋਤ ਹਨ